ਹੈਲੋ ਹਾਂ ਮਿੱਤਰ ਕੀ ਹਾਲ ਚਾਲ ਆ ਠੀਕ ਠਾਕ ਹੈ ਉਹ ਬਠਿੰਡੇ ਕਦੋਂ ਆਉਣਾ ਤੂੰ ਅਗਲੇ ਹਫ਼ਤੇ ਆ ਯਾਰ ਬਠਿੰਡੇ ਆਪਾਂ ਹੁਣ ਆਏ ਹਾਂ ਇੱਥੇ ਐਡਮਿਸ਼ਨ ਲਈ ਆ ਅਤੇ ਕੋਈ ਇੱਥੇ ਕਾਫੀ ਇਤਿਹਾਸਿਕ ਜਗ੍ਹਾਵਾਂ ਉੱਥੇ ਘੁੰਮ ਫਿਰ ਲਈਏ ਹਾਂ ਵੇਖਿਆ ਫਿਰ ਤੈਂ ਇੱਥੇ ਵੇਖਿਆ ਵੇ ਅਤੇ ਦਸਵੇਂ ਪਾਤਸ਼ਾਹ ਆਏ ਨੇ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜਿਵੇਂ ਕਿਲ੍ਹਾ ਮੁਬਾਰਕ ਆ ਉੱਥੇ ਵੀ ਦਸਵੇਂ ਪਾਤਸ਼ਾਹ ਨੇ ਚਰਨ ਪਾਏ ਆ ਹਾਜੀ ਰਤਨ ਅਤੇ ਇਕ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੂਸਰੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਸੀ ਭਾਈ ਮਨੀ ਸਿੰਘ ਤੋਂ ਗੁਰਬਾਣੀ ਲਿਖਾਈ ਸੀ ਉੱਥੇ ਲਿਖਣਸਰ ਗੁਰਦੁਆਰਾ ਸਾਹਿਬ ਆ ਅਤੇ ਦਮਦਮਾ ਸਾਹਿਬ ਤੁਸ ਸਿੱਖਾਂ ਦਾ ਪੰਜਵਾਂ ਤਖ਼ਤ ਵੀ ਆ ਦਮਦਮਾ ਸਾਹਿਬ ਤਾਂ

ਹਾਂ ਹਾਂ ਉੱਥੇ ਗੁਰੂ ਸਾਹਿਬ ਜੀ ਦੇ ਚੋਲਾ ਸਾਹਿਬ ਅਤੇ ਬਾਬਾ ਦੀਪ ਸਿੰਘ ਦਾ ਭੋਰਾ ਸਾਹਿਬ ਆ ਜਿੱਥੇ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਨਾ ਉਤਾਰੇ ਕੀਤੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਫੀ ਇਤਿਹਾਸਿਕ ਜਗ੍ਹਾ ਹੈ ਯਾਰ ਉੱਥੇ ਜਾਣਾ ਚਾਹੀਦਾ ਆਪਾਂ ਨੂੰ

ਰੁਕਣ ਦਾ ਆਪਾਂ ਬਠਿੰਡੇ ਹੀਬਣਾ ਲਵਾਂਗੇ ਬਠਿੰਡੇ ਹਾਜੀ ਰਤਨ ਇੱਦਾਂ ਕਰਾਂਗੇ ਨਾ ਆਪਾਂ ਇੱਥੋਂ ਯੂਨੀਵਰਸਿਟੀ ਜਾਵਾਂਗੇ ਸਿੱਧਾ ਜਾਵਾਂਗੇ ਹਾਜੀ ਰਤਨ ਹਾਜੀ ਰਤਨ ਤੋਂ ਕਿਲ੍ਹਾ ਮੁਬਾਰਕ ਦਰਸ਼ਨ ਕਰਦੇ ਹੋਏ ਅਤੇ ਆਪਾਂ ਮਤਲਬ ਕਿ ਦੁਪਹਿਰ ਦੋ ਕੁ ਵਜੇ ਉੱਥੇ ਜਾਵਾਂਗੇ ਦਮਦਮਾ ਸਾਹਿਬ ਨਾਲੇ ਤਲਵੰਡੀ ਸਾਹਿਬ ਉੱਥੇ ਲੰਗਰ ਪ੍ਰਸ਼ਾਦਾ ਛਕਾਂਗੇ ਅਤੇ ਸ਼ਾਮ ਨੂੰ ਸੱਤ ਵਜੇ ਤੱਕ ਉੱਥੇ ਰਹਾਂਗੇ ਉੱਥੋਂ ਫਿਰ ਆਪਾਂ ਸ਼ਾਮ ਨੂੰ ਸਿੱਧੇ ਯੂਨੀਵਰਸਿਟੀ ਆ ਜਾਂਗੇ ਇੱਥੇ ਹੀ ਰਹਿ ਜਾਵਾਂਗੇ ਨਾ

ਹਾਂ ਚੱਲ ਹਾਂ ਅਗਲੇ ਵੀਕੈਂਡ ਦਾ ਰੱਖ ਲਈਏ ਪ੍ਰੋਗਰਾਮ ਚੱਲ ਠੀਕ ਆ ਪੱਕਾ ਹੀ ਹੋਣਾ ਹਾਂ ਚੰਗਾ ਚੰਗਾ ਚੰਗਾ ਫਿਰ ਠੀਕ ਆ ਠੀਕ ਆ ਓਕੇ ਠੀਕ